ਮੈਂ ਸਵੈਟਰ ਜੁਰਾਬਾਂ ਟੋਪੀਆਂ ਆਦਿ ਬਣਾ ਲੈਂਦੀ ਹਾਂ ਕਿਉਂਕਿ ਅੱਜ ਕੱਲ੍ਹ ਇੰਟਰਨੈੱਟ ਦੇ ਉੱਤੇ ਅਲੱਗ ਅਲੱਗ ਡਿਜ਼ਾਇਨ ਟੋਪੀਆਂ ਦੇ ਅਲੱਗ ਅਲੱਗ ਡਿਜ਼ਾਇਨ ਜੁਰਾਬਾਂ ਦੇ ਅਲੱਗ ਅਲੱਗ ਡਿਜ਼ਾਇਨ ਸਵੈਟਰਾਂ ਦੇ ਉਪਲੱਬਧ ਹਨ ਅੱਜ ਕੱਲ੍ਹ ਯੂਟਿਊਬ ਤੋਂ ਵੀ ਬਹੁਤ ਸਾਰੀਆਂ ਚੀਜ਼ਾਂ ਬੁਣਾਈ ਲਈ ਮਿਲ ਜਾਂਦੀਆਂ ਹਨ ਅਤੇ ਬਜ਼ਾਰਾਂ ਵਿੱਚ ਵੀ ਬਹੁਤ ਸਾਰੀਆਂ ਕਿਤਾਬਾਂ ਸਾਨੂੰ ਮਿਲ ਜਾਂਦੀਆ ਹਨ ਜੇ ਮੈਂ ਇਸ ਵਿੱਚ ਇੱਕ ਰੁਜ਼ਗਾਰ ਦੀ ਗੱਲ ਕਰਾਂ ਤਾਂ ਮੈ ਰੁਜ਼ਗਾਰ ਲਈ ਕੁੜੀਆਂ ਨੂੰ ਜਾਂ ਲੇਡੀਜ਼ ਨੂੰ ਇਹ ਰੁਜ਼ਗਾਰ ਦੇਣਾ ਚਾਹਾਂਗੀ ਤਾਂ ਜੋ ਉਹ ਆਪਣੇ ਪਰਿਵਾਰ ਦਾ ਢਿੱਡ ਭਰ ਸਕਣ ਅਤੇ ਇੱਕ ਖੁਸ਼ਹਾਲ ਜੀਵਨ ਜੀ ਸਕਣ ਕਿਉਂਕਿ ਅੱਜ ਕੱਲ੍ਹ ਬਹੁਤ ਸਾਰੇ ਬਹੁਤ ਕੁੜੀਆਂ ਦਾ ਇਹ ਇਸ ਵਿੱਚ ਇੰਟਰੱਸਟ ਘੱਟ ਹੈ ਬੁਣਾਈ 'ਚ ਇੰਟਰੱਸਟ ਘੱਟ ਹੈ ਇਹ ਚੀਜ਼ਾਂ ਸਰਦੀ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ ਅਤੇ ਸਾਡੀ ਬਹੁਤ ਜ਼ਿਆਦਾ ਜਦੋਂ ਸਰਦੀ ਹੁੰਦੀ ਹੈ ਅਤੇ ਉਸ ਚੀਜ਼ ਨੂੰ ਢੱਕ ਲੈਂਦੀਆਂ ਹਨ